ਕੁਝ ਸਭ ਤੋਂ ਆਮ ਗਲਤੀਆਂ ਇਹ ਹਨ ਜੋ ਸ਼ੁਰੂਆਤ ਵਾਲੇ ਬਾਈਕਰ ਕਰਦੇ ਹਨ ਜਿਵੇਂ ਬਾਈਕ ਚਲਾਉਣ ਵੇਲੇ ਸੰਤੁਲਨ ਦਾ ਵਿਗਾੜ ਕਰਨਾ ਠੀਕ ਆ ਨਾ ਬਿਨਾਂ ਬੈਂਲਸ ਦੇ ਚਲਾਉਣਾ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਦੂਜੀ ਚੀਜ਼ ਬਾਈਕ ਚਲਾਉਣ ਵੇਲੇ ਸਾਨੂੰ ਗੇਅਰ ਪਾਉਣ ਦੀ ਲੋੜ ਪੈਂਦੀ ਹੈ ਅਤੇ ਨੋਰਮਲ ਜਿਹੜਾ ਆਮ ਵਿਅਕਤੀ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਗੇਅਰ ਕੀ ਹੁੰਦਾ ਤਾਂ ਉਹ ਕੀ ਕਰਦਾ ਨੋਰਮਲ ਚਲਾਉਂਦੇ ਚਲਾਉਂਦੇ ਗੇਅਰ ਪਾ ਦਿੰਦਾ ਉਹਦੇ ਨਾਲ ਕੀ ਹੁੰਦਾ ਝਟਕਾ ਮਾਰਦਾ ਇੰਜਣ ਨੂੰ ਨੁਕਸਾਨ ਜਾਂਦਾ ਜਾਂਦਾ ਆਮ ਵਿਅਕਤੀ ਨੂੰ ਵੀ ਨੁਕਸਾਨ ਜਾਂਦਾ ਇਸ ਕਰਕੇ ਜਦੋਂ ਵੀ ਸਾਨੂੰ ਗੇਅਰ ਪਾਉਣਾ ਬਾਈਕ 'ਚ ਤਾਂ ਇਹ 'ਚ ਕਲੱਚ ਨੂੰ ਗਿਵਨ ਹੁੰਦਾ ਤਾਂ ਆਪਾਂ ਕਲੱਚ ਨੂੰ ਦਬਾ ਕੇ ਗੇਅਰ ਪਾਈਏ ਤਾਂ ਹੌਲੀ ਹੌਲੀ ਕਲੱਚ ਛੱਡਦੇ ਛੱਡਦੇ ਨਾਲ ਨਾਲ ਰੇਸ ਦੇਵਾਂਗੇ ਅਤੇ ਅਰਾਮ ਨਾਲ ਬਾਈਕ ਚੱਲੇਗੀ ਠੀਕ ਆ ਨਾ ਅਤੇ ਇਹ ਗਲਤੀਆਂ ਆਮ ਬਾਈਕਰ ਕਰਦੇ ਨੇ ਸ਼ੁਰੂਆਤ 'ਚ ਪਰ ਸਾਨੂੰ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਇਹਦੇ ਜਿਵੇਂ ਕਿ ਕੁਝ ਸਖਤ ਨਿਯਮਾਂ ਦਾ ਪਾਲਣ ਇਹ ਹੈ ਕਿ ਸਾਨੂੰ ਬਲ ਬਾਈਕ ਹਮੇਸ਼ਾ ਹੀ ਸਲੋਅ ਚਲਾਉਣੀ ਚਾਹੀਦੀ ਜ਼ਿਆਦਾ ਫਾਸਟ ਨਹੀਂ ਚਲਾਉਣੀ ਚਾਹੀਦੀ ਇੱਕ ਦੂਜੇ ਨੂੰ ਓਵਰਟੇਕ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਵੱਡੇ ਰੋਡ 'ਤੇ ਵੱਡੀਆਂ ਟਰੱਕਾਂ ਨੂੰ ਓਵਰਟੇਕ ਕਦੀ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਸਾਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਸਾਨੂੰ ਹਮੇਸ਼ਾ ਡਰਾਈਵਿੰਗ ਕਰਨ ਵੇਲੇ ਹੈਲਮੇਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਪੁਲਿਸ ਅਧਿਕਾਰੀਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਇਸ ਪ੍ਰਕਾਰ ਆਪਾਂ ਇੱਕ ਵਧੀਆ ਬਾਈਕਰ ਬਣ ਸਕਦੇ ਹਾਂ